ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਬਲਵਿੰਦਰ ਬਿੰਦੂ ਹੈ ਮੈਂ ਮੋਹਾਲੀ ਦੀ ਰਹਿਣ ਵਾਲੀ ਹਾਂ ਮੈਂ ਤਕਰੀਬਨ ਵੀਹ ਮਿੰਟ ਪਹਿਲੇ ਕੋਲ ਕੀਤੀ ਸੀ ਮੈਂ ਦਾਲ ਅਤੇ ਚਾਰ ਲੱਸੀਆਂ ਸੀਗੀਆਂ ਔਰ ਤਿੰਨ ਰੋਟੀਆਂ ਦਾ ਔਡਰ ਦਿੱਤਾ ਸੀਗਾ ਅਤੇ ਤੁਹਾਡੇ ਡਿਲੀਵਰੀ ਪਾਰਟਨਰ ਬਾਰ ਬਾਰ ਮੈਂ ਫੋਨ ਕਰ ਰਹੀ ਹੈ ਪਰ ਮੇਰਾ ਫੋਨ ਨਹੀਂ ਚੱਕ ਰਿਹਾ ਇਸਦਾ ਕਾਰਨ ਕੀ ਹੈ ਕਿਉਂਕਿ ਮੇਰੇ ਘਰ ਗੈਸਟ ਆਏ ਹੋਏ ਹਨ ਅਤੇ ਤਕਰੀਬਨ ਦੋ ਘੰਟੇ 'ਤੇ ਦੋ ਘੰਟੇ ਬੀਤ ਗਏ ਹਨ ਦੋ ਘੰਟਾ ਤੱਕ ਤੁਹਾਡਾ ਪਾਰਟਨਰ ਇੱਥੇ ਪਹੁੰਚਿਆ ਨਹੀਂ ਮੈਨੂੰ ਇਹਦਾ ਕਰਨ ਦੱਸਿਆ ਜਾਵੇ ਅਤੇ ਇਹ ਵੀ ਦੱਸਿਆ ਜਾਵੇ ਕਿ ਉਹ ਇੱਥੇ ਕਿੰਨੇ ਵਜੇ ਪਹੁੰਚੇਗਾ